ਹੈਲੋ ਐਚ ਐਮ ਟੀ ਰਿਜ਼ੋਰਟ ਅਸੀਂ ਇਹ ਪਤਾ ਕਰਨਾ ਚਾਹੁੰਦੇ ਹਾਂ ਕਿ ਸ਼ਾਮ ਨੂੰ ਅਸੀਂ ਡਿਨਰ 'ਤੇ ਤੁਹਾਡੇ ਆਉਣਾ ਚਾਹੁੰਦੇ ਹਾਂ ਰੈਸਟੋਰੈਂਟ ਵਿੱਚ ਕਿ ਸਾਨੂੰ ਉਹਦੇ ਲਈ ਇੱਕ ਟੇਬਲ ਹੈ ਜਿਹੜਾ ਉਹ ਰਿਜ਼ਰਵੇਸ਼ਨ ਕਰ ਦਿੱਤਾ ਜਾਵੇ ਇਸ ਤੋਂ ਬਿਨਾਂ ਜੇਕਰ ਕੋਈ ਔਫਰ ਵੀ ਹੈ ਤਾਂ ਉਸਦੇ ਬਾਰੇ ਵੀ ਸਾਨੂੰ ਹੈ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ